ਅੱਜ ਦੇ ਟਾਈਮ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਅੱਜ ਕੱਲ੍ਹ ਬ ਅੱਜ ਕੱਲ੍ਹ ਸਾਰੇ ਟੈਕਨੋਲੋਜੀ ਨਾਲ ਜਿਵੇਂ ਕਿ ਬਹੁਤ ਚੰਗੀ ਤਰ੍ਹਾਂ ਜੁੜ ਚੁੱਕੇ ਹਨ ਬਹੁਤ ਜ਼ਿਆਦਾ ਅਤੇ ਅੱਜ ਕੱਲ੍ਹ ਲੋਕ ਟੈਕਨੋਲੋਜੀ ਦੇ ਬਿਨਾਂ ਰਹਿ ਵੀ ਨਹੀਂ ਸਕਦੇ ਮੇਨਲੀ ਮੋਬਾ ਮੋਬਾਇਲ ਫੋਨ ਜਿਹਦੇ ਜਿਹੜਾ ਕਿ ਅੱਜ ਤੱਕ ਜਿਹਦਾ ਬੋਲਬਾਲਾ ਅੱਜ ਦੁਨੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਆ ਮਤਲਬ ਹੋਰਾਂ ਤੈਕਨੋਲੋਜੀ ਟੈਕਨਲੋਜੀ ਟੇ ਗੈਜੇਟਾਂ ਤੋਂ ਇਲਾਵਾ ਅੱਜ ਕੱਲ੍ਹ ਸਿਰਫ ਇੱਕ ਫੋਨ ਹੀ ਹੈ ਜਿਹਦਾ ਬੋਲਬਾਲਾ ਬਹੁਤ ਜ਼ਿਆਦਾ ਆ ਲੋਕਾਂ ਦੇ ਵਿੱਚ ਅਤੇ ਲੋਕ ਉਸ ਤੋਂ ਬਿਨਾਂ ਰਹਿ ਵੀ ਨਹੀਂ ਸਕਦੇ ਅੱਜ ਕੱਲ੍ਹ ਲੋਕ ਕਿਤੇ ਅੱਜ ਕੱਲ੍ਹ ਸਾਰਿਆਂ ਕੋਲ ਆਪਦੇ ਆਪਦੇ ਸੈਲ ਫੋਨ ਆ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਕੋਲ ਆਪਦੇ ਆਪਦੇ ਸੈੱਲ ਫੋਨ ਹੈ ਅਤੇ ਜਿਹੜੇ ਜਾਂ ਅੱਜ ਕੱਲ੍ਹ ਜ਼ਿਆਦਾਤਰ ਅ ਅੱਜ ਦਾ ਯੂਥ ਹੀ ਹੈ ਜਿਹੜਾ ਫੋਨ ਦੇ ਨਾਲ ਬਹੁਤ ਜ਼ਿਆਦਾ ਚੰ ਬਹੁਤ ਕਹਿ ਸਕਦੇ ਕਿ ਬਹੁਤ ਜ਼ਿਆਦਾ ਜੁੜ ਚੁੱਕਿਆ ਮੋਬਾਇਲ ਫੋਨ ਦੇ ਨਾਲ ਅਤੇ ਦੁਨੀਆਂ ਮੋਬਾਇਲ ਫੋਨ ਤੋਂ ਬਿਨਾਂ ਨਹੀਂ ਰਹਿ ਸਕਦੀ ਆਪਾਂ ਮੋਬਾਈਲ ਫੋਨ 'ਤੇ ਈਜ਼ੀਲੀ ਕਿਤੇ ਵੀ ਬੈਠੇ ਕਿਸੇ ਨਾਲ ਵੀ ਇੰਟਰੈਕਟ ਕਰ ਸਕਦੇ ਹਾਂ ਐਂਡ ਆਪਾਂ ਮੋਬਾਈਲ ਫੋਨ 'ਤੇ ਕਿਤੇ ਵੀ ਬੈਠੇ ਕੋਈ ਵੀ ਨਿਊਜ਼ ਸੁਣ ਸਕਦੇ ਹਾਂ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਕਿਸੇ ਨੂੰ ਵੀ ਫੋਨ ਲਾ ਕੇ ਕਿਸੇ ਨਾਲ ਵੀਡੀਓ ਕਾਨਫਰੰਸ ਕਰ ਸਕਦੇ ਹਾਂ ਤਾਂ ਕਰਕੇ ਇਹ ਚੀਜ਼ ਇਹ ਚੀਜ਼ ਦੁਨੀਆਂ ਨੂੰ ਬਹੁਤ ਜ਼ਿਆਦਾ ਅਟਰੈਕਟ ਕਰਦੀ ਹੈ ਇਸ 'ਤੇ ਜਵਾਕ ਜਵਾਕ ਜਵਾਕ ਆਪਦੇ ਫਰੀ ਟਾਈਮ ਦੇ ਵਿੱਚ ਸਿਰਫ ਅੱਜ ਕੱਲ੍ਹ ਮੋਬਾਈਲ 'ਤੇ ਹੀ ਗੇਮਸ ਵਗੈਰਾ ਖੇਡਣੀਆਂ ਪਸੰਦ ਕਰਦੇ ਆ ਤਾਂ ਕਰਕੇ ਉਹ ਮੋਬਾਈਲ ਨਾਲ ਬਹੁਤ ਜ਼ਿਆਦਾ ਜੁੜ ਚੁੱਕੇ ਆ ਜਿਹੜੀਆਂ ਮੋਬਾਇਲ ਆ ਉਹ ਉਹਨਾਂ ਨੂੰ ਬਹੁਤ ਹੱਦ ਤੱਕ ਹਾਈ ਲੈਵਲ ਤੱਕ ਅਟਰੈਕਟ ਕਰਦਾ ਕਿਉਂਕਿ ਇਹ ਇੱਕ ਚੀਜ਼ ਹੀ ਐਵੇਂ ਦੀ ਹੈ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਆਪਾਂ ਨੂੰ ਫੰਕਸ਼ਨਸ ਮਿਲ ਜਾਂਦੇ ਹੈ ਬਹੁਤ ਜ਼ਿਆਦਾ ਇਹ ਆਪਾਂ ਨੂੰ ਈਜ਼ੀਲੀ ਉਹ ਅੱਜ ਕੱਲ੍ਹ ਤਾਂ ਇਹ ਚੀਪਏਬਲ ਵੀ ਬਣ ਬਣ ਚੁੱਕੇ ਆ ਅਤੇ ਇੱਕ ਇਹ ਮਤਲਬ ਈਜੀਲੀ ਪੋਕਟ ਦੇ ਵਿੱਚ ਪੈ ਜਾਂਦਾ ਤਾਂ ਕਰਕੇ ਵੀ ਲੋਕ ਇਸ ਨਾਲ ਹੀ ਜ਼ਿਆਦਾ ਅਟੈਚਡ ਰਹਿੰਦਾ ਅੱਜ ਕੱਲ੍ਹ ਲੋਕ ਕਿਸੇ ਨਾਲ ਗੱਲਾਂ ਬਾਤਾਂ ਕਰਨ ਦੀ ਬਜਾਏ ਆਪਦੇ ਫੋਨ 'ਤੇ ਹੀ ਟਾਈਮ ਸਪੈਂਡ ਕਰਨਾ ਪਸੰਦ ਕਰਦੇ ਆ ਅਤੇ ਇਹੀ ਹੀ ਟੈਕਨੋਲ ਟੈਕਨੋਲੋਜੀ ਦਾ ਇੱਕ ਗੈਜਟ ਹੈ ਮੋਬਾਇਲ ਫੋਨ ਜਿਹੜਾ ਕਿ ਨ ਜਿਹੜਾ ਬਹੁਤ ਜ਼ਿਆਦਾ ਜਿਹਦੇ ਨਾਲ ਲੋਕ ਜੁੜੇ ਹੋਏ ਆ ਅਤੇ ਮੈਂ ਵੀ ਕਹਿ ਸਕਦੀ ਹਾਂ ਕਿ ਮੈਂ ਖੁਦ ਵੀ ਮੋਬਾਇਲ ਫੋਨ ਨਾਲ ਬਹੁਤ ਚੰਗੀ ਤਰ੍ਹਾਂ ਜੁੜੀ ਹੋਈ ਐਂ